ਮੈਂ ਹੰਢਿਆਇਆ ਤੋਂ ਹਾਂ ਮੈ ਬਿਜਲੀ ਬੋਰਡ ਨੂੰ ਫੋਨ ਲਗਾਇਆ ਹੈ

ਜਿਸ ਕਰਕੇ ਸਾਨੂੰ ਘਰ ਵਿੱਚ ਬਹੁਤ ਮੁਸ਼ਕਿਲ ਨਾ ਸਾਹਮਣਾ ਕਰਨਾ ਪੈਂਦਾ ਹੈ ਕੋਠੇ ਉੱਪਰ ਕੱਪੜੇ ਸੁਕਾਉਣ ਜਾਣ ਜਾਂਦੇ ਹਾਂ ਤਾਂ ਸਾਨੂੰ ਤਾਰਾਂ ਬਹੁਤ ਦਿੱਕਤ ਤਾਰਾਂ ਤੋਂ ਬਹੁਤ ਦਿੱਕਤ ਆਉਂਦੀ ਹੈ ਕਿਰਪਾ ਕਰਕੇ ਸਾਡੀ ਮਜਬੂਰੀ ਹੀ ਹੈ ਸਾਡੇ ਘਰ ਦੀਆਂ ਤਾਰਾਂ ਦਾ ਸੁਧਾਰ ਜਲਦ ਤੋਂ ਜਲਦ ਹੋ ਸਕੇ ਮੇਰਾ ਪਿੰਡ ਹਢਿਆਇਆ ਜ਼ਿਲ੍ਹਾ ਬਰਨਾਲਾ ਹੈ ਮੈਂ ਬਿਜਲੀ ਬੋਰਡ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਕੰਮ ਜਲਦ ਹੋ ਜਾਏ ਕਿਰਪਾ ਕਰਕੇ ਮੇਰੀ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਘਰ ਵਿੱਚ ਬਹੁਤ ਲੰਬੀਆਂ ਤਾਰਾਂ ਲੱਗੀਆਂ ਹੈ ਇਸ ਕਰਕੇ ਸਾਨੂੰ ਘਰ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕੱਪੜੇ ਸੁਕਾਉਣ ਜਾਂਦੇ ਹਾਂ ਤਾਂ ਸਾਨੂੰ ਤਾਰਾਂ ਬਹੁਤ ਅੜਿੱਕਾ ਲਾਉਂਦੀਆਂ ਹਨ ਇਸ ਕਰਕੇ ਸਾਡੀਆਂ ਤਾਰਾਂ ਦਾ ਸੁਧਾਰ ਜਲਦ ਤੋਂ ਜਲਦ ਹੋ ਜਾਏ ਮੇਰੀ ਬਿਜਲੀ ਬੋਰਡ ਨੂੰ ਇਹੀ ਬੇਨਤੀ ਹੈ ਅਸੀਂ ਹਢਿਆਇਆ ਤੋਂ ਹਢਿਆਇਆ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਨਿਵਾਸੀ ਹਾਂ ਕਿਰਪਾ ਕਰਕੇ ਸਾਡੀ ਮਜਬੂਰੀ ਹੀ ਹੈ ਸਾਡੇ ਘਰ ਦੀਆਂ ਤਾਰਾਂ ਦਾ ਸੁਧਾਰ ਜਲਦ ਹੋ ਸਕੇ ਮੇਰਾ ਪਿੰਡ ਹੰਢਿਆਇਆ ਜ਼ਿਲ੍ਹਾ ਬਰਨਾਲਾ ਹੈ ਮੈਂ ਬਿਜਲੀ ਬੋਰਡ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਕੰਮ ਜਲਦ ਤੋਂ ਜਲਦ ਹੋ ਜਾਏ ਕਰਨਾ ਪੈਂਦਾ ਹੈ ਕੱਪੜੇ ਸੁਕਾਉਣ ਜਾਂਦੇ ਹਾਂ ਤਾਂ ਸਾਨੂੰ ਬਹੁਤ ਮੁਸ਼ਕਿਲ ਮੁਸ਼ਕਿਲ ਜਾਂ ਦਿੱਕਤ ਸਾਹਮਣਾ ਕਰਨਾ ਪੈਂਦਾ ਹੈ ਕਿਰਪਾ ਕਰਕੇ ਸਾਡੀ ਮਜਬੂਰੀ ਸਮਝੀ ਜਾਵੇ ਅਤੇ ਸਾਡਾ ਕੰਮ ਜਲਦ ਤੋਂ ਜਲਦ ਹੋ ਜਾਏ ਧੰਨਵਾਦ ਕਿਰਪਾ ਕਰਕੇ ਸਾਡਾ ਕੰਮ ਜਲਦ ਤੋਂ ਜਲਦ ਹੋ ਜਾਏ